ਸਾਨੂੰ ਬਾਈਕਿੰਗ ਯਾਨੀ ਕਿ ਮੋਟਰਸਾਈਕਲ ਸ਼ੁਰੂ ਕਰਾਉਣ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਇਸ 'ਤੇ ਸਾਈਕਲ ਪਹਿਲਾਂ ਚਲਾਉਂਦੇ ਸੀ ਸਾਈਕਲ ਤੋਂ ਬਾਅਦ ਮੋਟਰਸਾਈਕਲ ਆਏ ਅਤੇ ਉਸ ਦੇ ਵਿੱਚ ਕੰਮ ਜਲਦੀ ਹੋਣ ਲੱਗਿਆ ਅਤੇ ਜਲਦੀ ਪਹੁੰਚਣ ਲੱਗ ਗਏ ਅਤੇ ਕਈ ਸਾਲਾਂ ਤੋਂ ਜਦੋਂ ਚਲਾਉਂਦੇ ਰਹੇ ਉਸਦੇ ਲਾਲ ਜਨੂੰਨ ਇਸ ਤਰ੍ਹਾਂ ਵਿਕਸਿਤ ਹੋਇਆ ਜਿੱਥੇ ਭੀੜ ਭਰੇ ਇਲਾਕਿਆਂ ਦੇ ਵਿੱਚ ਕਾਰਾਂ ਜਾਣਦਾ ਜਲਦੀ ਨਹੀਂ ਹੋ ਸਕਦਾ ਔਖਾ ਹੈ ਅਤੇ ਮੋਟਰਸਾਈਕਲ ਉੱਥੇ ਆਸਾਨੀ ਨਾਲ ਪਹੁੰਚ ਜਾਂਦਾ ਹੈ ਇਸ ਲਈ ਮੋਟਰਸਾਈਕਲ ਦੀ ਵਰਤੋਂ ਜਦ ਥੋੜ੍ਹੇ ਇੱਕ ਤੋਂ ਜ਼ਿਆਦਾ ਜਾਣਿਆਂ ਲਈ ਜਾਣ ਲਈ ਹੀ ਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਲਈ ਮੋਟਰਸਾਈਕਲ ਇੱਕ ਜਣੇ ਦੇ ਜਾਣ ਲਈ ਇੱਕ ਵਰਤੋਂ ਕਰਦਾ ਹੈ ਅਤੇ ਇਹ ਤੰਗ ਗਲੀਆਂ ਅਤੇ ਭੀੜ ਭੜੱਕੇ ਦੇ ਇਲਾਕੇ ਦੇ ਵਿੱਚੋਂ ਵੀ ਜਲਦੀ ਦੇਣੇ ਅਤੇ ਚੰਗੀ ਤਰ੍ਹਾਂ ਲੰਘ ਸਕਦਾ ਹੈ ਇਸ ਲਈ ਮੈਨੂੰ ਗੱਡੀ ਕਾਰ ਦੇ ਨਾਲੋਂ ਇਹ ਜ਼ਿਆਦਾ ਪਸੰਦ ਆਇਆ ਅਤੇ ਇਸ ਲਈ ਮੈਨੂੰ ਪਰੁ ਪ੍ਰੇਰਿਤ ਹੋਇਆ ਮੋਟਰਸਾਈਕਲ ਤੋਂ ਮੈਂ ਅਤੇ ਇਸ ਦਾ ਜਨੂੰਨ ਜਦੋਂ ਦੇ ਇਸ ਲਈ ਵਧਿਆ ਤਾਂ ਜੋ ਕਾਰ ਦੇ ਨਾਲੋਂ ਭੀੜ ਭੜੱਕੇ ਜਾਂ ਭਰੀਆਂ ਥਾਂਵਾਂ ਦੇ ਵਿੱਚ ਜਲਦੀ ਨਿਕਲ ਜਾਂਦੇ ਹਾਂ ਇਸ ਲਈ ਇਹ ਜਲਦੀ ਹੈ